ਯੋਗ ਅਭਿਆਸ ਵਿੱਚ ਧਿਆਨ ਬਹੁਤ ਧਿਆਨ ਦੀ ਬਹੁਤ ਜ਼ਰੂਰੀ ਭੂਮਿਕਾ ਹੈਗੀ ਹੈ ਧਿਆਨ ਲਾਉਣ ਨਾਲ ਸਾਡੀਆਂ ਕਾਫੀ ਤਰ੍ਹਾਂ ਦੀਆਂ ਜਿਵੇਂ ਮਾਨਸਿਕ ਰੋਗ ਹੈਗੇ ਆਪਾਂ ਨੂੰ ਉਹ ਦੂਰ ਹੁੰਦੇ ਆ ਜਿਵੇਂ ਆਪਣਾ ਬਿਮਾਰੀਆਂ ਹੁੰਦੀਆਂ ਮਾਨਸਿਕ ਅਤੇ ਉਹ ਮਤਲਬ ਉਹਨਾਂ ਦੇ ਸੰਤੁਲਿਤ ਸੰਤੁਲਨ ਰੱਖਿਆ ਜਾ ਸਕਦਾ ਧਿਆਨ ਲਗਾਉਣ ਨਾਲ ਸਾ ਸਾਨੂੰ ਜਿਵੇਂ ਅਸੀਂ ਹੋਰ ਹੋਰ ਦੂਜੀਆਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਹਾਂ ਇਸ ਨਾਲ ਅਸੀਂ ਆਪਣੀ ਇੱਕ ਪਰਮਾਤਮਾ ਨਾਲ ਵੀ ਧਿਆਨ ਲਗਾ ਸਕਦੇ ਹਾਂ ਜੀ ਅਸੀਂ ਧਿਆਨ ਲਗਾਉਂਦੇ ਤਾਂ ਆਪਣਾ ਸਿੱਧਾ ਪਰਮਾਤਮਾ ਨਾਲ ਵੀ ਧਿਆਨ ਲੱਗਦਾ ਇਸ ਲਈ ਧਿਆਨ ਧਿਆਨ ਲਗਾਉਣ ਨਾਲ ਸਾਡੇ ਜਿਵੇਂ ਬਿਮਾਰੀਆਂ ਹੁੰਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਨੂੰ ਹੁੰਦੀਆਂ ਸਾਡੇ ਸਾਡੇ ਸਰੀਰ ਵਿੱਚ ਧਿਆਨ ਲਗਾਉਣ ਨਾਲ ਉਹ ਵੀ ਦੂਰ ਹੁੰਦੀਆਂ ਇਸ ਲਈ ਜਦੋਂ ਯੋਗ ਅਸੀਂ ਕਰਦੇ ਹਾਂ ਮੈਂ ਵੀ ਯੋਗ ਅਸੀਂ ਕਰਦੇ ਧਿਆਨ ਲਗਾਉਣਾ ਵੀ ਬਹੁਤ ਜ਼ਰੂਰੀ ਜਿਵੇਂ ਭਲਾ ਕੋਈ ਦੋ ਮਿੰਟ ਲਾਏ ਭਲਾ ਕੋਈ ਪੰਜ ਮਿੰਟ ਲਾਏ ਮੈਂ ਵੀ ਆਪਣੀ ਜਦੋਂ ਐਕਸਰਸਾਈਜ ਕਰਦੀ ਹਾਂ ਅਤੇ ਮੈਂ ਵੀ ਪੰਜ ਕੁ ਮਿੰਟ ਆਪਦਾ ਧਿਆਨ ਲਗਾਉਂਦੀ ਹਾਂ ਤਾਂ ਬਹੁਤ ਸ਼ਾਂਤੀ ਮਿਲਦੀ ਹੈ ਇਸ ਨਾਲ ਸਾਡਾ ਮਾਨਸਿਕ ਸੰਤੁਲਨ ਵੀ ਬਣਿਆ ਰਹਿੰਦਾ ਹੈਗਾ ਅਤੇ ਸਲੀਕ ਸਰੀਰ ਵੀ ਤੰਦਰੁਸਤ ਰਹਿੰਦਾ ਹੈਗਾ